ਹਾਂਜੀ ਮੈਮ ਹੈਲੋ ਹਾਂਜੀ ਮੈਮ ਹਾਂਜੀ ਜੀ ਤੁਸੀਂ ਸੁਣਾਓ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਰੋਹਨ ਵੀ ਮੇਰੇ ਨਾਲ ਇਹੀ ਗੱਲ ਕਰੀ ਕਰਦਾ ਜੀ ਕਿ ਉਹਨੂੰ ਵੀ ਦਿੱਕਤ ਆਉਂਦੀ ਹੈ ਡਾਂਸ ਸਿੱਖਦੇ ਕਿਉਂਕਿ ਬਹੁਤ ਜਿਆਦਾ ਸ਼ੋਰ ਹੁੰਦਾ ਹੈ ਤੇ ਹਾਂਜੀ ਇੱਕ ਤੇ ਦੇਖ ਲੋ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਹਾਂਜੀ ਹਾਂਜੀ ਫਿਰ ਅਕੈਡਮੀ ਦੀ ਫੀਸ ਕਿੰਨੀ ਹੋਏਗੀ ਹਾਂਜੀ ਤੇ ਜਗਾ ਕਿਹੜੀ ਹੋਏਗੀ ਹਾਂਜੀ ਹਾਂਜੀ ਫਿਰ ਮੈਂ ਗੱਲ ਕਰਕੇ ਦੇਖਦੀ ਆ ਠੀਕ ਐ ਮੈਮ